ਪੰਜਾਬ ਵਿੱਚ ਮਹੱਤਵਪੂਰਨ ਇਤਿਹਾਸਿਕ ਸਮਾਰਕ ਜਿਵੇਂ ਕਿ ਜਲਿਆਂਵਾਲਾ ਬਾਗ ਅਤੇ ਚੱਪੜ ਚਿੜੀ ਦੇ ਸਥਾਨ ਹਨ ਜਲਿਆਂਵਾਲਾ ਬਾਗ ਸਾਨੂੰ ਉੱਨੀ ਸੋ ਉੱਨੀ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਵਾਪਰੀ ਜਲਿਆਂ ਵਾਲੇ ਬਾਗ ਦੇ ਵਿੱਚ ਜੋ ਦੁਖਾਂਤ ਵਾਪਰਿਆ ਉਹ ਰੋਂਗਟੇ ਖੜੇ ਕਰਨ ਵਾਲਾ ਇਤਿਹਾਸ ਯਾਦ ਦਵਾਉਦਾ ਹੁੰਦਾ ਹੈ ਅਤੇ ਚੱਪੜਚਿੜੀ ਦੇ ਸਥਾਨ ਤੇ ਸਾਨੂੰ ਬੰਦਾ ਬਹਾਦਰ ਅਤੇ ਉਸਦੀ ਵੀਰਤਾ ਸੂਰਬੀਰਤਾ ਬਾਰੇ ਸਾਨੂੰ ਜੋ ਹੈ ਯਾਦ ਦਵਾਉਂਦਾ ਹੈ ਅਤੇ ਸਾਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ